ਆਮ ਤੌਰ 'ਤੇ ਭਾਰਤ ਵਿੱਚ ਤਰ੍ਹਾਂ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਹਰ ਇੱਕ ਤਿਉਹਾਰ ਦੀ ਆਪਣੀ ਹੀ ਇੱਕ ਮਹੱਤਤਾ ਹੁੰਦੀ ਹੈ ਇਹ ਤਿਉਹਾਰ ਹਨ ਦੀਵਾਲੀ ਦੁਸਹਿਰਾ ਅਤੇ ਹੋਲੀ ਪਰ ਇਨ੍ਹਾਂ ਤੋਂ ਵੀ ਇੱਕ ਪ੍ਰਮੁੱਖ ਤਿਉਹਾਰ ਹੈ ਲੋਹੜੀ ਦਾ ਜੋ ਕਿ ਲੋਕਾਂ ਵਿੱਚ ਬਹੁਤ ਹੀ ਪ੍ਰਚਲਿਤ ਹੈ ਇਸ ਦਿਨ ਹਰ ਕਿਤੇ ਛੁੱਟੀ ਹੁੰਦੀ ਹੈ ਚਾਹੇ ਉਹ ਸਕੂਲ ਹੋਵੇ ਜਾਂ ਕੋਈ ਸਰਕਾਰੀ ਅਦਾਰਾ ਇਸ ਦਿਨ ਸਾਰੇ ਰਲ਼ ਮਿਲ਼ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਲੋਹੜੀ ਦਾ ਤਿਉਹਾਰ ਖਾਸ ਮੌਕੇ ਜਿਵੇਂ ਕਿ ਘਰ ਵਿੱਚ ਕੋਈ ਵਿਆਹ ਹੋਵੇ ਉਦੋਂ ਅਤੇ ਘਰ ਵਿੱਚ ਇੱਕ ਨਵਜੰਮੇ ਇੱਕ ਘਰ ਵਿੱਚ ਮੁੰਡਾ ਜਾਂ ਕੁੜੀ ਦਾ ਜਨਮ ਹੋਇਆ ਹੋਵੇ ਉਦੋਂ ਇਹ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਲੋਹੜੀ ਦੇ ਰਾਤ ਨੂੰ ਸਾਰੇ ਲੱਕੜਾਂ ਬਾਲ ਕੇ ਅਤੇ ਉਸ ਵਿਚ ਤਿਲ ਰੇਵੜੀਆਂ ਮੂੰਗਫਲੀਆਂ ਪਾ ਕੇ ਲੋਹੜੀ ਮਨਾਉਂਦੇ ਹਨ ਅਤੇ ਇੱਕ ਕਹਾਵਤ ਇੱਕ ਅਖਾਣ ਵੀ ਪਾਉਂਦੇ ਹਨ ਤਿਲ ਸੜੇ ਪਾਪ ਚੜੇ ਇਸ ਤਿਉਹਾਰ ਨੂੰ ਲੋਕ ਬਹੁਤ ਹੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਦਿਨ ਨਿੱਘੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਗਰਮੀ ਮਹਿਸੂਸ ਹੋਣ ਲੱਗ ਪੈਂਦੀ ਹੈ ਇਸ ਲਈ ਮੇਰੇ ਹਿਸਾਬ ਨਾਲ ਲੋਹੜੀ ਦਾ ਤਿਉਹਾਰ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ